ਰੇਲ ਗੱਡੀ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਯਾਤਰਾ ਕਰਦੇ ਸਮੇਂ ਸਾਡਾ ਸੰਪਰਕ ਵੱਖ ਵੱਖ ਲੋਕਾਂ ਨਾਲ ਹੁੰਦਾ ਹੈ ਹਾਲਾਂਕਿ ਮੈਂ ਅਜੇ ਰੇਲ ਗੱਡੀ 'ਤੇ ਸਫਰ ਨਹੀਂ ਸੀ ਕੀਤਾ ਪਰ ਆਪਣੇ ਪਿਤਾ ਜੀ ਤੋਂ ਇਹੋ ਜਿਹੇ ਤਜਰਬਿਆਂ ਬਾਰੇ ਸੁਣਿਆ ਸੀ ਹੁਣ ਇੱਕ ਦਿਨ ਆਇਆ ਜਦੋਂ ਰੇਲ ਗੱਡੀ ਰਾਹੀਂ ਯਾਤਰਾ ਕਰਨ ਦਾ ਅਨੁਭਵ ਕਰਨ ਲਈ ਖਾਸ ਤੌਰ 'ਤੇ ਮੈਨੂੰ ਮੌਕਾ ਮਿਲਿਆ ਜੋ ਕਿ ਆਵਾਜਾਈ ਦਾ ਮੇਰੇ ਲਈ ਇੱਕ ਨਵਾਂ ਸਾਧਨ ਸੀ ਮੈਂ ਆਪਣੇ ਪਰਿਵਾਰ ਨਾਲ ਯਾਤਰਾ ਕਰੀ ਜਿਸ ਨੇ ਸਾਹਸ ਅਤੇ ਉਮੀਦ ਦੀ ਸਮੁੱਚੀ ਭਾਵਨਾ ਨੂੰ ਵਧਾ ਦਿੱਤਾ ਯਾਤਰਾ ਇਉਂ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਆਪਣੀ ਰੇਲ ਗੱਡੀ ਵਿੱਚ ਚੜ੍ਹੇ ਤਾਂ ਰੇਲ ਗੱਡੀ ਦਾ ਸਟੇਸ਼ਨ ਸਰਗਰਮੀ ਨਾਲ ਗੂੰਜ ਉੱਠਿਆ ਅੱਗੇ ਦੀ ਯਾਤਰਾ ਦੀ ਉਮੀਦ ਨਾਲ ਹਵਾ ਸੰਘਣੀ ਹੋ ਗਈ ਜਿਵੇਂ ਹੀ ਰੇਲ ਗੱਡੀ ਪਲੈਟਫਾਰਮ ਤੋਂ ਤੁਰੀ ਮੈਂ ਤਾਲਬੱਧ ਆਵਾਜ਼ ਅਤੇ ਲੰਘਦੇ ਦ੍ਰਿਸ਼ਾਂ ਦੇ ਧੁੰਦਲੇਪਣ ਦੁਆਰਾ ਮੋਹਿਤ ਹੋ ਗਿਆ ਫਿਰ ਮੇਰਾ ਧਿਆਨ ਖਿੜਕੀ ਅਤੇ ਸੀਟਾਂ ਵੱਲ ਗਿਆ ਮੈਂ ਖੁਸ਼ਕਿਸਮਤ ਸੀ ਕਿ ਮੈਨੂੰ ਖਿੜਕੀ ਵਾਲੀ ਸੀਟ ਮਿਲੀ ਜਿਸ ਨੇ ਮੈਨੂੰ ਹਰੇ ਭਰੇ ਖੇਤਾਂ ਤੋਂ ਲੈ ਕੇ ਭੀੜ ਭੜੱਕੇ ਵਾਲੇ ਸ਼ਹਿਰਾਂ ਤੱਕ ਬਦਲਦੇ ਦ੍ਰਿਸ਼ਾਂ ਨੂੰ ਦੇਖਣ ਦਾ ਸੁਨਹਿਰਾ ਮੌਕਾ ਦਿੱਤਾ ਫਿਰ ਸਾਥੀ ਯਾਤਰੀਆਂ ਨਾਲ ਗੱਲਬਾਤ ਕਰਨ ਦਾ ਵੀ ਸੁਭਾਗ ਮਿਲਿਆ ਮੈਂ ਆਪਣੇ ਆਪ ਨੂੰ ਦੂਜੇ ਯਾਤਰੀਆਂ ਨਾਲ ਗੱਲਬਾਤ ਕਰਨ ਉਹਨਾਂ ਦੀਆਂ ਕਹਾਣੀਆਂ ਅਤੇ ਮੰਜ਼ਿਲਾਂ ਬਾਰੇ ਸਿੱਖਣ ਵਿੱਚ ਰੁੱਝਿਆ ਪਾਇਆ ਜਿਸ ਨੇ ਯਾਤਰਾ ਵਿੱਚ ਵਿਲੱਖਣ ਮਨੁੱਖੀ ਅਹਿਸਾਸ ਜੋੜਿਆ ਖਾਣਾ ਵਿਕਰੇਤਾ ਰੇਲ ਯਾਤਰਾ ਦੀ ਇੱਕ ਤਿਉਹਾਰ ਵੀ ਸੀ ਵਿਕਰੇਤਾ ਕਈ ਤਰ੍ਹਾਂ ਦੇ ਸਨੈਕਸ ਅਤੇ ਪੀਣ ਵਾਲੇ ਪਦਾਰਥ ਵੇਚ ਰਹੇ ਸਨ ਜੋ ਸਮੁੱਚੇ ਅਨੁਭਵ ਨੂੰ ਵਧਾਉਂਦੇ ਹਨ ਯਾਤਰਾ ਦਾ ਸਭ ਤੋਂ ਯਾਦਗਾਰ ਹਿੱਸਾ ਦਿੱਲੀ ਦੀਆਂ ਜੀਵੰਤ ਹਰੇ ਭਰੇ ਨਜ਼ਾਰਿਆਂ ਤੋਂ ਲੈ ਕੇ ਮੈਦਾਨਾਂ ਤੱਕ ਲੈਂਡਸਕੇਪ ਦੇ ਪਰਿਵਰਤਨ ਨੂੰ ਦੇਖਣਾ ਸੀ ਟਰੇਨ ਦੇ ਤਾਲਬੱਧ ਜਗ ਡਗ ਡਗ ਦੀ ਯਾਤਰਾ ਲਈ ਇੱਕ ਆਰਾਮ ਦਾ ਇਕ ਸਾਊਂਡ ਟਰੈਕ ਬਣ ਗਈ ਜੋ ਸਾਡੀ ਮੰਜ਼ਿਲ ਵੱਲ ਸਾਡੀ ਗਤੀ ਦੀ ਨਿਰੰਤਰ ਯਾਦ ਦਿਵਾਉਂਦੀ ਹੈ ਮਨੁੱਖੀ ਸੰਬੰਧ ਬਾਰੇ ਵੀ ਮੈਂ ਉਸ ਦਿਨ ਕਾਫੀ ਕੁਝ ਸਿੱਖਿਆ ਸਾਥੀ ਯਾਤਰੀਆਂ ਨਾਲ ਗੱਲਬਾਤ ਕਰਨ ਅਤੇ ਕਹਾਣੀਆਂ ਸਾਂਝੀਆਂ ਕਰਨ ਨਾਲ ਦੋਸਤੀ ਅਤੇ ਸੰਬੰਧ ਦੀ ਭਾਵਨਾ ਪੈਦਾ ਹੋਈ ਜੋ ਮੈਂ ਪਹਿਲਾਂ ਕਦੇ ਅਨੁਭਵ ਨਹੀਂ ਸੀ ਕੀਤੀ ਜਿਵੇਂ ਹੀ ਟਰੇਨ ਦਿੱਲੀ ਸਟੇਸ਼ਨ 'ਤੇ ਪਹੁੰਚੀ ਮੈਨੂੰ ਭਾਵਨਾਵਾਂ ਦਾ ਮਿਸ਼ਰਣ ਮਹਿਸੂਸ ਹੋਇਆ ਉਤਸਾਹ ਰਾਹਤ ਅਤੇ ਉਦਾਸੀ ਦਾ ਇੱਕ ਸੰਕੇਤ ਦੀ ਕੀ ਯਾਤਰਾ ਖਤਮ ਹੋ ਗਈ ਹੈ ਕਿਉਂ ਜੋ ਮੇਰੀ ਯਾਤਰਾ ਅੰਮ੍ਰਿਤਸਰ ਤੋਂ ਆਰੰਭ ਹੋ ਕੇ ਦਿੱਲੀ ਤੱਕ ਦੀ ਹੀ ਸੀ ਸਿੱਟਾ ਇਹ ਰਿਹਾ ਕਿ ਮੇਰੀ ਪਹਿਲੀ ਰੇਲ ਯਾਤਰਾ ਸਿਰਫ ਇਕ ਯਾਤਰਾ ਹੀ ਨਹੀਂ ਬਲਕਿ ਇੱਕ ਸਾਹਸ ਸੀ ਜਿਸ ਨੇ ਮੇਰੇ ਆਲੇ ਦੁਆਲੇ ਦੀ ਦੁਨੀਆਂ ਲਈ ਹੈਰਾਨੀ ਅਤੇ ਕਦਰਦਾਨੀ ਦੀ ਭਾਵਨਾ ਨੂੰ ਜਗਾਇਆ ਇਹ ਖੋਜ ਦੀ ਯਾਤਰਾ ਸੀ ਦੋਵਾਂ ਦ੍ਰਿਸ਼ਾਂ ਦੇ ਰੂਪ ਵਿੱਚ ਜੋ ਮੈਂ ਦੇਖਿਆ ਅਤੇ ਜਿਹਨਾਂ ਲੋਕਾਂ ਨੂੰ ਮੈਂ ਮਿਲਿਆ ਇਸ ਨੇ ਮੇਰੀ ਯਾਦਾਸ਼ਤ 'ਤੇ ਇੱਕ ਅਮਿਟ ਛਾਪ ਛੱਡੀ ਧੰਨਵਾਦ